ਪਸ਼ੂ ਪਾਲਣ ਵਿੱਚ ਸਨਕ ਅਤੇ ਅੱਗੇ ਵੇਸ ਵਿਦੇਸ਼ੀ ਨਸਲਾਂ ਵਿੱਚ ਬਹੁਤ ਹੀ ਫਰਕ ਹੈ ਪਸ਼ੂ ਪਾਲਣ ਪੰਜਾਬ ਵਿੱਚ ਹਨ ਅਤੇ ਇਹ ਕਈ ਤਰ੍ਹਾਂ ਦੀ ਖਾਦਾ ਪਾਲਣ ਪੋਸ਼ਣ ਖਲ ਖਾਦ ਵਗੈਰਾ ਦਾ ਬਹੁਤ ਚਾਰਾ ਧਿਆਨ ਰੱਖਿਆ ਜਾਂਦਾ ਸੀ ਉਹ ਪੰਜਾਬ ਵਿੱਚ ਹੁੰਦੇ ਹਨ ਅਤੇ ਪਸ਼ੂ ਦਾ ਧਿਆਨ ਬਹੁਤ ਧਿਆਨ ਨਾਲ ਕੀਤਾ ਜਾਂਦਾ ਹੈ ਪਾਲਣ ਬਹੁਤ ਧਿਆਨ ਨਾਲ ਕੀਤਾ ਜਾਂਦਾ ਹੈ ਅਤੇ ਵਿਦੇਸ਼ੀ ਨਸਲਾਂ ਅਤੇ ਪਸ਼ੂ ਪਾਲਣ ਵਿੱਚ ਬਹੁਤ ਸਾਰਾ ਅੰਤਰ ਹੁੰਦਾ ਏ ਵਿਦੇਸ਼ੀ ਨਸਲ ਵਿੱਚ ਉਹ ਭੂਰੀ ਹੁੰਦੇ ਹਨ ਅਤੇ ਉਨ ਉਹ ਪਸ਼ੂ ਪਸ਼ੂ ਪਾਲਣ ਤੇ ਵਿਦੇਸ਼ੀ ਨਸਲਾਂ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ ਪਸ਼ੂ ਪਾਲਣ ਤਾਂ ਦੁੱਧ ਘੱਟੋ ਘੱਟ ਦਸ ਤੋਂ ਬਾਰ੍ਹਾਂ ਕਿਲੋ ਦਿੰਦੀ ਹੈ ਅਤੇ ਵਿਦੇਸ਼ੀ ਨਸਲ ਦੇ ਘੱਟੋ ਘੱਟ ਚਾਲ੍ਹੀ ਪੰਤਾਲੀ ਦੁੱਧ ਦਿੰਦੀ ਹੈ ਅਤੇ ਉਹਨਾਂ ਨੂੰ ਉਹ ਮੈਂ ਵਿਦੇਸ਼ੀ ਨਸਲ ਤਾਂ ਮਹਿੰਗੀ ਵੀ ਬਹੁਤ ਹੈ ਉਹਨਾਂ ਦਾ ਖਾਨ ਪਦਾਨ ਵੀ ਬਹੁਤ ਚਾਰਾ ਮਹਿੰਗਾ ਏ ਅਤੇ ਉਨਾਂ ਦਾ ਪਾਲਣ ਪੋਸ਼ਨ ਵੀ ਬਹੁਤ ਮਹਿੰਗਾ ਹੈ ਔਰ ਕਈ ਤਰ੍ਹਾਂ ਬਹੁਤ ਜ਼ਿਆਦਾ ਦੁੱਧ ਦਿੰਦੀਆਂ ਹਨ ਅਤੇ ਉਹਨਾਂ ਦਾ ਰਹਿਣ ਸਹਿਣ ਖਾਣ ਪਾਣ ਸਭ ਕੁਝ ਬਹੁਤ ਮਹਿੰਗਾ ਹੈ ਅਤੇ ਪਸ਼ੂ ਪਾਲਣ ਅਤੇ ਉਹ ਉਨਾਂ ਦੇ ਜਿੰਨਾ ਜਿਆਦਾ ਦੁੱਧ ਦਿੰਦੀਆਂ ਹਨ ਵਿਦੇਸ਼ੀ ਨਸਲਾਂ ਉਹਨਾਂ ਜਿਆਦਾ ਵੱਧ ਤੋਂ ਵੱਧ ਉਮਰ ਤੋਂ ਵੀ ਉਹ ਠੀਕ ਰਹਿੰਦੀਆਂ ਹਨ ਅਤੇ ਬਹੁਤ ਜ਼ਿਆਦਾ ਮਹਿੰਗਾ ਉਹਨਾਂ ਦਾ ਰਹਿਣ ਸਹਿਣ ਏ ਅਤੇ ਜਿਹੜੇ ਪਸ਼ੂ ਪਾਲਣ ਹਨ ਉਹਨਾਂ ਦਾ ਵਿਦੇਸ਼ੀ ਨਸਲਾਂ ਨਾਲੋਂ ਘੱਟ ਖਰਚਾ ਏ ਖਾਣ ਪੀਣ ਉਹਨਾਂ ਦਾ ਘੱਟ ਹੈ ਅਤੇ ਉਹ ਜ਼ਿਆਦਾ ਉਮਰ ਤੱਕ ਵੀ ਨਹੀਂ ਰਹਿੰਦੀਆਂ ਅਤੇ ਉਹਨਾਂ ਦਾ ਪਾਲਣ ਪੋਸ਼ਣ ਵੀ ਬਹੁਤ ਘੱਟ ਏ ਉਹ ਜ਼ਿਆਦਾਤਰ ਬਿਮਾਰ ਹੋ ਕੇ ਜਲਦੀ ਬਿਮਾਰ ਹੋ ਜਾਂਦੀਆਂ ਹਨ